ਅਸੀਂ ਪੰਜਾਬ ਸੂਬੇ ਨੂੰ ਬਿਲੌਂਗ ਕਰਦੇ ਹਾਂ ਅਸੀਂ ਬਚਪਨ ਤੋਂ ਹੀ ਪੰਜਾਬੀ ਬੋਲ ਰਹੇ ਹਾਂ ਲੇਕਿਨ ਜਦੋਂ ਬਚਪਨ ਵਿੱਚ ਅਸੀਂ ਪੰਜਾਬੀ ਲਿਖਣੀ ਸ਼ੁਰੂ ਕੀਤੀ ਤਾਂ ਥੋੜ੍ਹੀਆਂ ਦਿੱਕਤਾਂ ਆਈਆਂ ਕਿਉਂਕਿ ਕੋਈ ਵੀ ਭਾਸ਼ਾ ਕੋਈ ਵੀ ਕੁਝ ਵੀ ਸਿੱਖਦੇ ਅਸੀਂ ਤਾਂ ਸਾਨੂੰ ਪਹਿਲਾਂ ਪਹਿਲਾਂ ਦਿੱਕਤਾਂ ਆਉਂਦੀਆਂ ਹਨ ਅਤੇ ਹੌਲੀ ਹੌਲੀ ਸਾਨੂੰ ਉਸ ਕੰਮ 'ਚ ਨਿਪੁੰਨਤਾ ਆ ਜਾਂਦੀ ਹੈ ਇਸੇ ਤਰ੍ਹਾਂ ਅਸੀਂ ਪੰਜਾਬੀ ਹੁਣ ਬੋਲ ਰਹੇ ਹਾਂ ਔਰ ਸਾਨੂੰ ਮਾਣ ਪ੍ਰਾਪਤ ਹੁੰਦਾ ਹੈ ਕਿ ਅਸੀਂ ਐਡੇ ਵੱਡੇ ਪੰਜਾਬ ਸੂਬੇ ਨੂੰ ਬਿਲੌਂਗ ਕਰਦੇ ਹਾਂ ਗੁੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਜਿਸ ਨੂੰ ਅਸੀਂ ਬਿਲੌਂਗ ਕਰਦੇ ਹਾਂ ਔਰ ਸਾਨੂੰ ਪੰਜਾਬੀ ਬੋਲਣ 'ਚ ਬਹੁਤ ਮਾਣ ਪ੍ਰਾਪਤ ਹੁੰਦਾ ਹੈ ਕਈ ਚਲੋ ਪੰਜਾਬੀ ਦੇ ਅੱਖਰ ਇਹੋ ਜਿਹੇ ਹਨ ਜਿਹੜੇ ਪਹਿਲਾ ਜਿੱਦਾਂ ਦਾੜਾ ਕੱਘਾ ਕਈ ਜਿਨ੍ਹਾਂ 'ਚ ਜੀਭ ਸਾਡੀ ਲੜਖੜਾ ਜਾਂਦੀ ਹੈ ਪਹਿਲਾਂ ਪਰੋਬਲਮ ਆਈ ਸੀ ਹੁਣ ਜਦੋਂ ਜਦੋਂ ਅਸੀਂ ਬੋਲਣੀ ਸ਼ੁਰੂ ਕੀਤੀ ਅਸੀਂ ਬੋਲਦੇ ਗਏ ਉਮਰ ਦੇ ਹਿਸਾਬ ਨਾਲ ਹੁਣ ਸਾਨੂੰ ਪੰਜਾਬੀ ਬੋਲਣ 'ਚ ਕੋਈ ਪਰੇਸ਼ਾਨੀ ਨਹੀਂ ਆਉਂਦੀ ਔਰ ਸਾਨੂੰ ਮਾਣ ਪ੍ਰਾਪਤ ਹੁੰਦਾ ਹੈ ਕਿ ਅਸੀਂ ਪੰਜਾਬ ਸੂਬੇ ਨੂੰ ਬਿਲੌਂਗ ਕਰਕੇ ਆਪਣੀ ਮਾਤਰ ਭਾਸ਼ਾ ਨਾਲ ਜੁੜੇ ਹੋਏ ਹਾਂ ਔਰ ਪੰਜਾਬ ਨੂੰ ਅਸੀਂ ਪ੍ਰਫੁੱਲਿਤ ਪੰਜਾਬੀ ਕਰਨੀ ਹੈ ਪੰਜਾਬ ਨੂੰ ਪ੍ਰਫੁੱਲਿਤ ਕਰਨਾ ਹੈ ਔਰ ਪੰਜਾਬੀ ਅਸੀਂ ਬੋਲ ਰਹੇ ਹਾਂ ਸਾਨੂੰ ਅਜਿਹੀ ਕੋਈ ਹੁਣ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਅਤੇ ਅਸੀਂ ਆਪਣੇ ਅਗਲੀ ਪੀੜ੍ਹੀ ਨੂੰ ਵੀ ਇਸ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਾਂ ਸਾਨੂੰ ਮਾਣ ਪ੍ਰਾਪਤ ਹੁੰਦਾ ਹੈ ਕਿ ਅਸੀਂ ਪੰਜਾਬੀ ਹਾਂ ਔਰ ਅਸੀਂ ਬੋਲ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ